ਮੈਂ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਅਤੇ ਮੈਂ ਗੱਲ ਕਰ ਰਿਹਾ ਪੁਰਾਣੇ ਗੱਲ ਕਰਦਾ ਪੁਰਾਣੇ ਜ਼ਮਾਨੇ ਦੀ ਗੱਲ ਜਿਵੇਂ ਸਾਨੂੰ ਪਤਾ ਹੈ ਕਿ ਪਹਿਲਾਂ ਛੋਟੇ ਬੱਚੇ ਵੱਖ ਵੱਖ ਗੇਮਾਂ ਖੇਡਦੇ ਸਨ ਜ਼ਿਆਦਾਤਰ ਉਹ ਬਾਹਰ ਵਾਲੀਆਂ ਗੇਮਾਂ ਖੇਡਦੇ ਸਨ ਜਿਵੇਂ ਕਬੱਡੀ ਸਟਾਪੂ ਲੁਕਣ ਮੀਚੀ ਆਦਿ ਔਰ ਜਿੱਦਾਂ ਹੁਣ ਸਮਾਂ ਬਦਲ ਗਿਆ ਹੈ ਅਤੇ ਇਸ ਦੇ ਨਾਲ ਅੱਜ ਦੇ ਜ਼ਮਾਨੇ ਵਿੱਚ ਅੱਜ ਕੱਲ੍ਹ ਅਸੀਂ ਦੇਖ ਰਹੇ ਸਕਦੇ ਹਾਂ ਕਿ ਹਰ ਇੱਕ ਛੋਟਾ ਬੱਚਾ ਹਰ ਵੇਲੇ ਮੋਬਾਇਲ ਦੀ ਜ਼ਿੱਦ ਕਰਦਾ ਹੈ ਅਤੇ ਜ਼ਿਆਦਾਤਰ ਉਹ ਮੋਬਾਈਲ ਵਿੱਚ ਹੀ ਲੱਗਾ ਰਹਿੰਦਾ ਹੈ ਸਮਾਂ ਖੇਡਦੇ ਹਨ ਅਤੇ ਅਸੀਂ ਉਹਨਾਂ ਨੂੰ ਇਹ ਰੋਕਣ ਦੀ ਕੋਸ਼ਿਸ਼ ਕਰੀਏ ਤਾਂ ਉਹ ਰੋਣ ਲੱਗ ਪੈਂ ਜਾਂਦੇ ਹਨ ਅਸੀਂ ਜਾਣਦੇ ਹਾਂ ਕਿ ਅੱਜ ਕੱਲ੍ਹ ਦੇ ਬੱਚਿਆਂ ਵਿੱਚ ਬਾਹਰ ਵਾਲੀਆਂ ਖੇਡਾਂ ਖੇਡਣਾ ਰੁਝਾਨ ਘਟ ਰਿਹਾ ਹੈ ਪਰ ਇਸ ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਬਾਹਰ ਵਾਲੀਆਂ ਖੇਡਾਂ ਖੇਡਣ ਨਾਲ ਸਾਡਾ ਸਰੀਰਕ ਤੰਦਰੁਸਤੀ ਰਹਿੰਦੀ ਹੈ ਅਤੇ ਅਸੀਂ ਸਾਰੇ ਸਾਰੇ ਹੋਰ ਸਿਹਤਮੰਦ ਰਹਿੰਦੇ ਹਾਂ ਪਰ ਜਿਵੇਂ ਹੁਣ ਛੋਟੇ ਬੱਚੇ ਮੋਬਾਇਲ ਉੱਤੇ ਜ਼ਿਆਦਾਤਰ ਗੇਮਾਂ ਖੇਡਦੇ ਰਹਿੰਦੇ ਹਨ ਮੋਬਾਇਲ ਦਾ ਸਿੱਧਾ ਅਸਰ ਉਹਨਾਂ ਦੀਆਂ ਅੱਖਾਂ ਉੱਤੇ ਪੈਂਦਾ ਹੈ ਜਿਸ ਕਾਰਨ ਉਹਨਾਂ ਦੀਆਂ ਅੱਖਾਂ ਖਰਾਬ ਹੋ ਸਕਦੀਆਂ ਹਨ ਅੰਤ ਅੰਤ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਕੱਲ ਬੱਚਿਆਂ ਨੂੰ ਵੱਧ ਤੋਂ ਵੱਧ ਬਾਹਰ ਵਾਲੀਆਂ ਗੇਮਾਂ ਖੇਡਣੀਆਂ ਚਾਹੀਦੀਆਂ ਹਨ